ਹੈਲੋ ਅਸੀਂ ਟੀ ਵੀ ਸ਼ ਸ਼ਾਰਕ ਟੈਂਕ ਤੋਂ ਨਹੀਂ ਜਾਣੂ ਹਾਂ ਇਸ ਲਈ ਸਾਨੂੰ ਇਸ ਦੇ ਬਾਰੇ ਕੋਈ ਨੌਲੇਜ ਨਹੀਂ ਹੈ